ਪੰਛੀਆਂ ਦੀ ਸੁਰਕਸ਼ਾ ਵਿੱਚ ਪੰਛੀਆਂ ਦੇਖਣ ਵਾਲਿਆਂ ਦਾ ਵੀ ਬਹੁਤ ਵੱਡਾ ਹੱਥ ਹੈ ਜੇਕਰ ਪੰਛੀ ਦੇਖਣ ਵਾਲਿਆਂ ਦੀ ਤਾਦਾਦ ਵੱਧ ਜਾਵੇ ਤਾਂ ਮੇਰਾ ਖਿਆਲ ਹੈ ਕਿ ਪੰਛੀਆਂ ਦੇ ਰਹਿਣ ਦੇ ਸਥਾਨ ਅਤੇ ਪੰਛੀਆਂ ਦੀ ਸੁਰਕਸ਼ਾ ਵਿੱਚ ਵੀ ਵਾਧਾ ਹੋ ਜਾਵੇਗਾ ਪੰਛੀਆਂ ਦੇ ਰਹਿਣ ਲਈ ਵੱਧ ਤੋਂ ਵੱਧ ਪੇੜ ਲਗਾਏ ਜਾਣਗੇ ਜਿਸ ਨਾਲ ਹਵਾ ਵੀ ਸਾਫ਼ ਹੋ ਜਾਵੇਗੀ ਅਤੇ ਕੁਦਰਤ ਦਾ ਵੀ ਫਾਇਦਾ ਹੋਵੇਗਾ ਪੰਛੀਆਂ ਨੂੰ ਰਹਿਣ ਲਈ ਬਿਹਤਰ ਮਾਹੌਲ ਮਿਲੇਗਾ ਪੰਛੀਆਂ ਨੂੰ ਦੇਖ ਦੇਖ ਕੇ ਪੰਛੀਆਂ ਬਾਰੇ ਮਿਲੀ ਜਾਣਕਾਰੀ ਨੂੰ ਸਮਝ ਕੇ ਪੰਛੀਆਂ ਦੀ ਘੱਟਦੀ ਜਾ ਰਹੀ ਆਬਾਦੀ ਨੂੰ ਰੋਕ ਕੇ ਪੰਛੀਆਂ ਦੀ ਆਬਾਦੀ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਕੁਦਰਤ ਨੂੰ ਵੀ ਬਹੁਤ ਵੱਡਾ ਫਾਇਦਾ ਹੋਵੇਗਾ ਧਰਤੀ 'ਤੇ ਕੁਦਰਤ ਦਾ ਇੱਕ ਸੋਹਣਾ ਤੋਹਫਾ ਹੋਰ ਪਨ ਪਾਵੇਗਾ